ਮੀਡੀਆ ਜਿਵੇਂ ਕਿ ਰੇਡੀਓ ਟੈਲੀਵਿਜ਼ਨ ਪ੍ਰਿੰਟ ਵਿੱਚ ਪੰਜਾਬੀ ਦੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਆ ਕਿਉਂਕਿ ਇਸ ਨੂੰ ਅਸੀਂ ਜਿਵੇਂ ਆਮ ਬਜ਼ੁਰਗ ਲੋਕ ਨੂੰ ਵੀ ਪੜ੍ਹਦੇ ਨੇਗੇ ਤਾਂ ਜੋ ਉਹਨਾਂ ਦਾ ਜਿਹੜਾ ਪੜ੍ਹਨ ਦਾ ਜਿਹੜਾ ਇੱਕ ਖਾਬ ਆ ਉਹ ਅਧੂਰਾ ਨਾ ਰਹਿ ਸਕੇ ਜਿਵੇਂ ਰੇਡੀਓ ਉੱਤੇ ਪੰਜਾਬੀ ਖਬਰਾਂ ਟੈਲੀਵਿਜ਼ਨ ਅਤੇ ਕੋਈ ਪੰਜਾਬੀ ਚੈਨਲ ਪ੍ਰਿੰਟਿੰਗ ਦੇ ਵਿੱਚ ਅਸੀਂ ਉਹਨੂੰ ਕਰ ਸਕਦੇ ਹਾਂ ਤਾਂ ਜੋ ਜਿਹੜੀ ਇੱਕ ਜਿਹੜੇ ਸਾਡੇ ਪੰਜਾਬੀ ਦੇ ਕੁਛ ਅਲੋਪ ਹੋ ਰਹੇ ਸ਼ਬਦ ਨੇ ਉਹ ਜਿਹੜੇ ਉਹ ਜ਼ਿੰਦਾ ਰਹਿ ਸਕਣ ਅਤੇ ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹਨਾਂ ਸ਼ਬਦਾਂ ਬਾਰੇ ਦੱਸ ਕੇ ਉਹਨਾਂ ਦੇ ਮਤਲਬਾਂ ਬਾਰੇ ਦੱਸ ਸਕੀਏ ਅਤੇ ਉਹਨਾਂ ਦੀ ਜਿਹੜੀ ਪਰਲੋ ਸੀ ਉਹ ਅਸੀਂ ਕਿਸ ਢੰਗ ਨਾਲ ਕਦੋਂ ਕਰਦੇ ਸੀ ਕਿਵੇਂ ਕਰਦੇ ਸੀ ਕਿੰਨੇ ਵਧੀਆ ਤਰੀਕੇ ਨਾਲ ਕਰਦੇ ਸੀ ਇਹ ਸਭ ਕੁਛ ਵੀ ਅਸੀਂ ਆਪਣੇ ਪੰਜਾਬੀ ਭਾਸ਼ਾ ਨੂੰ ਅੱਗੇ ਰੱਖ ਕੇ ਹੀ ਕਰ ਸਕਦੇ ਅੱਜ ਕੱਲ੍ਹ ਸਰਕਾਰ ਵੀ ਇਸ ਬਾਰੇ ਬਹੁਤ ਕੁਛ ਦੱਸ ਰਹੀ ਆ ਵੀ ਸਾਨੂੰ ਹਰ ਇੱਕ ਜਿਵੇਂ ਕੋਈ ਵੀ ਕੈਫੇ ਆ ਕੋਈ ਵੀ ਰਿਸੋਰਟ ਆ ਜਾਂ ਕੋਈ ਵੀ ਪੈਲਸ ਹੋਣਾ ਸਮਝੋ ਉਹਨਾਂ ਨੇ ਨਾਮ ਪੰਜਾਬੀ ਦੇ ਵਿੱਚ ਵੀ ਲਿਖਵਾਏ ਨੇ ਤਾਂ ਜੋ ਜਿਹੜਾ ਇੱਕ ਦੂਰ ਤੋਂ ਆਇਆ ਜਾਂ ਇੱਕ ਸਿਰਫ ਘੱਟ ਪੜ੍ਹਿਆ ਲਿਖਿਆ ਵਿਅਕਤੀ ਵੀ ਆ ਜਿਹੜਾ ਉਸਨੂੰ ਦੇਖ ਕੇ ਲੱਭ ਸਕੇ ਮੇਨ ਇਸ ਚੀਜ਼ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ